ਜਦੋਂ ਵੀ ਆਪਣੇ ਕੋਲ ਸਮਾਂ ਅਤੇ ਸਮੱਗਰੀ ਘੱਟ ਹੁੰਦੀ ਹੈ ਤਾਂ ਜ਼ਿਆਦਾਤਰ ਆਪਾਂ ਸੁਣਦੇ ਹਾਂ ਕਿ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਸਮਾਂ ਨਹੀਂ ਸੀ ਜ਼ਿਆਦਾ ਜਾਂ ਸਮੱਗਰੀ ਘੱਟ ਪੈ ਗਈ ਅਤੇ ਇਸ ਕਰਕੇ ਭੋਜਨ ਖਰਾਬ ਹੋ ਗਿਆ ਪਰ ਹੁਣ ਮੈਂ ਮੈਨੂੰ ਜਿੱਥੋਂ ਤੱਕ ਪਤਾ ਕਿ ਜਦੋਂ ਮੇਰੇ ਕੋਲ ਸਮਾਂ ਅਤੇ ਸਮੱਗਰੀ ਦੋਵੇਂ ਚੀਜ਼ਾਂ ਘੱਟ ਹੁੰਦੀਆਂ ਨੇ ਜਾਂ ਸਮਾਂ ਘੱਟ ਹੋਵੇ ਜਾਂ ਸਮੱਗਰੀ ਘੱਟ ਹੋਵੇ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਉਨੇ ਕੁ ਸਮੇਂ ਦੇ ਵਿੱਚ ਅਤੇ ਉਨੀ ਕੁ ਸਮੱਗਰੀ ਦੇ ਵਿੱਚ ਚੀਜ਼ ਥੋੜ੍ਹੀ ਬਣਾ ਲੈਣੀ ਚਾਹੀਦੀ ਆ ਪਰ ਉਹਨੂੰ ਭੋਜਨ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਲੋਕ ਕੀ ਕਰਦੇ ਨੇ ਕਿ ਸਮਾਂ ਘੱਟ ਹੋਣ 'ਤੇ ਸਮੱਗਰੀ ਘੱਟ ਹੋਣ 'ਤੇ ਚੀਜ਼ ਜਿਆਦਾ ਬਣਾ ਲੈਂਦੇ ਨੇ ਅਤੇ ਪਰ ਉਸਦਾ ਜਿਹੜਾ ਉਹਨੂੰ ਖਰਾਬ ਕਰਕੇ ਬੈਠ ਜਾਂਦੇ ਨੇ ਅਤੇ ਜਦੋਂ ਆਪਣੇ ਕੋਲ ਸਮੱਗਰੀ ਘੱਟ ਹੋਵੇ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਸਮੱਗਰੀ ਵੀ ਘੱਟ ਹੋਵੇ ਜਾਂ ਆਪਣੇ ਕੋਲ ਸਮਾਂ ਵੀ ਘੱਟ ਹੋਵੇ ਸਮੇਂ ਘੱਟ ਵਿੱਚ ਕੀ ਕਰਨਾ ਚਾਹੀਦਾ ਜਿਵੇਂ ਆਪਾਂ ਕੋਈ ਵੀ ਸਬਜ਼ੀ ਬਣਾਉਣੀ ਹੈ ਤਾਂ ਉਹਦਾ ਵਾ ਤੜਕਾ ਵੱਖ ਨਹੀਂ ਲਾਉਣਾ ਚਾਹੀਦਾ ਸਾਰੀ ਸਬਜ਼ੀ ਵਿੱਚ ਪਾ ਕੇ ਕੁੱਕਰ ਦੇ ਅਤੇ ਉਸ ਦੇ ਵਿੱਚ ਹੀ ਸਾਰਾ ਕੁਛ ਮਸਾਲਾ ਪਾ ਕੇ ਤੜਕਾ ਪਾ ਕੇ ਅਤੇ ਉਹਨੂੰ ਵਿੱਚੇ ਲਾ ਲਏ ਤੜਕਾ ਵੱਖ ਨਹੀਂ ਬਣਾਉਣਾ ਚਾਹੀਦਾ ਇਸ ਨਾਲ ਸਾਡੇ ਸਮੇਂ ਦੀ ਵੀ ਬਹੁਤ ਬੱਚਤ ਹੁੰਦੀ ਆ ਅਤੇ ਸਮੱਗਰੀ ਦੀ ਵੀ ਬਹੁਤ ਬੱਚਤ ਹੁੰਦੀ ਹੈ